ਮੈਂ ਔਨਲਾਈਨ ਸ਼ੋਪਿੰਗ ਤੋਂ ਪਰਫਿਊਮ ਮੰਗਵਾਇਆ ਫੋਗ ਕੋਂਪਣੀ ਦਾ ਅਤੇ ਮੈਨੂੰ ਉਹਦੇ ਪਰ ਔਫਰ ਮਿਲਿਆ ਇੱਕ ਨਾਲ ਇੱਕ ਫਰੀ ਜਦੋਂ ਮੈਂ ਔਡਰ ਕੀਤਾ ਪਰਫਿਊਮ ਬਹੁਤ ਵਧੀਆ ਅਤੇ ਜੋ ਵੀ ਫਿਰ ਮੈਂ ਪਰਫਿਊਮ ਦੇਖ ਕੇ ਮੈਨੂੰ ਚੀਜ਼ ਵਧੀਆ ਲੱਗੀ ਫਿਰ ਮੈਂ ਉਹਦੇ ਪਰ 'ਤੇ ਕੱਪੜੇ ਔਨਲਾਈਨ ਕੀਤੇ ਜੈਕਿਟ ਲੋਅਰ ਟੀਸ਼ਰਟ ਪੈਂਟ ਬੂਟ ਵੀ ਹਾਂ ਔਨਲਾਈਨ ਚੀਜ਼ ਵਧੀਆ ਹੁੰਦੀ ਬਹੁਤ ਵਧੀਆ ਸਮਾਨ ਮਿਲਦਾ ਔਨਲਾਈਨ ਪਰ ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਪਰਫਿਊਮ ਤੋਂ ਪਰਫਿਊਮ ਬਹੁਤ ਵਧੀਆ ਨਿਕਲਿਆ ਅ ਫਿਰ ਮੈਂ ਦੈਨ ਔਨਲਾਈਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਸ ਔਨਲਾਈਨ ਸ਼ੋਪਿੰਗ ਬਹੁਤ ਵਧੀਆ ਸਮਾਨ ਬਹੁਤ ਵਧੀਆ ਮਿਲਦਾ ਔਨਲਾਈਨ ਕਰੋ ਵਧੀਆ ਰਹਿੰਦੇ ਚੀਜ਼ ਵੀ ਸਸਤੀ ਮਿਲਦੀ ਹੈ ਚੀਜ਼ ਵਧੀਆ ਨਿਕਲਦੀ ਹੈ ਬਹੁਤ ਘੈਂਟ ਚੀਜ਼ ਨਿਕਲੀ ਪਰਫਿਊਮ ਫੋਗ ਦਾ ਤਾਂ ਬਹੁਤ ਘੈਂਟ ਨਿਕਲਿਆ